ਸਤਿ ਸ਼੍ਰੀ ਅਕਾਲ ਜੀ ਤੁਸੀਂ ਜੇ ਪੀ ਕਮਿਊਨੀਕੇਸ਼ਨ ਤੋਂ ਬੋਲ ਰਹੇ ਹੋ ਭਾਅ ਜੀ ਮੈਂ ਤੁਹਾਡੇ ਤੋਂ ਕੁਝ ਟਾਈਮ ਪਹਿਲਾਂ ਇੱਕ ਸੈਕਿੰਡ ਹੈਂਡ ਲੈਪਟਾਪ ਲਿੱਤਾ ਸੀ ਅਤੇ ਉਹ ਲੈਪਟਾਪ ਤਾਂ ਕੁਝ ਦਿਨ ਤਾਂ ਕਾਫ਼ੀ ਵਧੀਆ ਚੱਲਿਆ ਪਰ ਜਿਵੇਂ ਜਿਵੇਂ ਮੈਂ ਇਸਨੂੰ ਯੂਜ ਕਰਦਾ ਗਿਆ ਤਾਂ ਮੈਂ ਇੱਕ ਪ੍ਰੋਬਲਮ ਫੇਸ ਕਰੀ ਕਿ ਉਸ ਲੈਪਟਾਪ ਦਾ ਬੈਟਰੀ ਬੈਕਅੱਪ ਬਿਲਕੁਲ ਨਹੀਂ ਹੈ ਹਾਰਡਲੀ ਅਡ ਦੋ ਤੋਂ ਤਿੰਨ ਘੰਟੇ ਵਿਦ ਚਾਰਜਿੰਗ ਕੱਢਦਾ ਉਹ ਅਤੇ ਭਾਅ ਜੀ ਤੁਹਾਡੀ ਇੰਨੀ ਵ ਵੱਡੀ ਦੁਕਾਨ ਹੈ ਅਤੇ ਮੈਂ ਤੁਹਾਡੇ ਤੋਂ ਇਹ ਉਮੀਦ ਨਹੀਂ ਕਰ ਸਕਦਾ ਸੀ ਕਿ ਤੁਹਾਡੀ ਸ਼ੋਪ ਵਿੱਚ ਇਹੋ ਜਿਹਾ ਸਮਾਨ ਹੋਵੇਗਾ ਕਿਉਂਕਿ ਰੀਜ਼ਨ ਤੁਹਾਨੂੰ ਪਤਾ ਹੀ ਹੈ ਜੇ ਪੀ ਕਮਿਊਨੀਕੇਸ਼ਨ ਦਾ ਕਪੂਰਥਲੇ ਵਿੱਚ ਕਿੰਨਾ ਨਾਮ ਹੈ ਭਾਅ ਜੀ ਮੈਂ ਤੁਹਾਨੂੰ ਇੰਨੀ ਬੇਨਤੀ ਕਰ ਸਕਦਾ ਹੈ ਕਿ ਇਹ ਪ੍ਰੋਡਕਟ ਮੇਰਾ ਜਾਂ ਫਿਰ ਵਾਪਿਸ ਕੀਤਾ ਜਾਵੇ ਜਾਂ ਇਸ ਦੀ ਥਾਂ ਮੈਨੂੰ ਕੋਈ ਔਰ ਪ੍ਰੋਡਕਟ ਦਿੱਤਾ ਜਾਵੇ ਕਿਉਂਕਿ ਮੈਂ ਤੁਹਾਡੇ ਸਾ ਤੁਹਾਡੇ ਦੁਕਾਨ ਤੋਂ ਪਹਿਲਾਂ ਵੀ ਬਹੁਤ ਕਾਫ਼ੀ ਸਮਾਨ ਲੈ ਚੁੱਕਿਆ ਹੈ ਪਰ ਇਹ ਜਿਹਾ ਸਮਾਨ ਕਦੇ ਨਹੀਂ ਆਇਆ ਇੱਦਾਂ ਮੈਂ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਨਾਲ ਮੇਰੇ ਸੰਬੰਧ ਕੱਲ੍ਹ ਦਿਨ ਖਰਾਬ ਹੋਵੇ ਅਤੇ ਬੇਨਤੀ ਹੈ ਸਰ ਤੁਹਾਡੇ ਤੋਂ ਇੱਕ ਕਿ ਇਹ ਸਾਮਾਨ ਪਲੀਜ਼ ਵਾਪਿਸ ਕੀਤਾ ਜਾਵੇ ਜਾਂ ਫਿਰ ਇਸ ਦੀ ਥਾਂ ਮੈਨੂੰ ਕੋਈ ਹੋਰ ਸਾਮਾਨ ਦਿੱਤਾ ਜਾਵੇ ਧੰਨਵਾਦ